ਮੈਨੂੰ ਸਭ ਤੋਂ ਦੇਲੀ ਦਿਲਚਸਪ ਜਗ੍ਹਾ ਹੈਗੀ ਹੈ ਉਹ ਲੱਗਦੀ ਹੈਗੀ ਹੈ ਸ਼੍ਰੀ ਆਨੰਦਪੁਰ ਸਾਹਿਬ ਜਿੱਦਾਂ ਹੁਣ ਸਾਡਾ ਨਵਾਂਸ਼ਹਿਰ ਜ਼ਿਲ੍ਹਾ ਹੈ ਨਵਾਂਸ਼ਹਿਰ ਜ਼ਿਲ੍ਹੇ ਦੇ ਥੋੜ੍ਹੀ ਦੂਰ ਹੈਗਾ ਹੈ ਸ਼੍ਰੀ ਆਨੰਦਪੁਰ ਸਾਹਿਬ ਉੱਥੇ ਮੈਨੂੰ ਜਾਣਾ ਅਕਸਰ ਹੀ ਮੈਂ ਉੱਥੇ ਜਿੱਦਾਂ ਤਿਉ ਕੋਈ ਵੀ ਤਿਉਹਾਰ ਹੁੰਦਾ ਦਿਨ ਦੇ ਹਿਸਾ ਹੁੰਦਾ ਹੈਗਾ ਹੈ ਉੱਥੇ ਮੈਂ ਜਾਣਾ ਪਸੰਦ ਕਰਦਾ ਹੈਗਾ ਹੈ ਕਿਉਂਕਿ ਜਿਹੜੇ ਇੱਥੇ ਜਿਹੜੇ ਸਾਡੇ ਸਿੱਖਾਂ ਦੇ ਦਸਵੇਂ ਗੁਰੂ ਹੋਏ ਹੈਗੇ ਹੈ ਉਹਨਾਂ ਨੇ ਇੱਥੇ ਸੋਲ੍ਹਾਂ ਸੌ ਨੜਿਨਵੇਂ ਈਸਵੀ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀਗੀ ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਸੀਗਾ ਅਤੇ ਪੰਜ ਸਿੱਖਾਂ ਤੋਂ ਖੁਦ ਅੰਮ੍ਰਿਤ ਛਕਿਆ ਸੀਗਾ ਇਸ ਤੋਂ ਇਲਾਵਾ ਹੈਗੀ ਜਿਹੜੀ ਇਸ ਜਗ੍ਹਾ ਦੀ ਖਾਸ ਚੀਜ਼ ਹੈਗੀ ਹੈ ਇਹ ਉਸ ਜਗ੍ਹਾ ਦੀ ਖਾਸ ਚੀਜ਼ ਇਹ ਹੈਗੀ ਹੈ ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਪੱਚੀ ਸਾਲ ਬਿਤਾਏ ਸੀਗੇ ਉਹਨਾਂ ਨੇ ਅਤੇ ਇੱਥੇ ਜਿਹੜੇ ਰਹਿ ਕੇ ਗੁਰੂ ਜੀ ਨੇ ਕਾਫੀ ਜੰਗਾਂ ਮੁਗਲਾਂ ਮੁਗਲਾਂ ਨਾਲ ਅਤੇ ਪਹਾੜੀ ਰਾਜਿਆਂ ਨਾਲ ਕਾਫੀ ਜੰਗਾਂ ਲੜੀਆਂ ਅਤੇ ਉਹਨਾਂ 'ਤੇ ਜਿੱਤ ਵੀ ਪ੍ਰਾਪਤ ਕੀਤੀ ਹੈਗੀ ਹੈ ਇਸ ਕਰਕੇ ਮੈਨੂੰ ਇੱਥੇ ਅਕਸਰ ਹੀ ਜਾਣਾ ਵਧੀਆ ਲੱਗਦਾ ਹੈਗਾ ਮੈਂ ਆਪਣੀ ਫੈਮਿਲੀ ਨਾਲ ਇੱਥੇ ਜਾਂਦਾ ਹੈਗਾ ਇੱਥੇ ਵਿਰਾਸਤ ਏ ਖਾਲਸਾ ਵੀ ਬਣਿਆ ਹੋਇਆ ਹੈਗਾ ਹੈ ਜੋ ਸਾਨੂੰ ਜਿਹੜੀ ਸਿੱਖਾਂ ਦੀ ਹੈਗੀ ਹੈ ਜਿੱਦਾਂ ਮੰਨ ਲਉ ਉਹਨਾਂ ਦਾ ਜਿਹੜਾ ਸਿੱਖਾਂ ਦਾ ਇਤਿਹਾਸ ਹੈਗਾ ਉਹ ਦੱਸਦਾ ਹੈਗਾ ਅਤੇ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਮ ਉਹ ਉਹ ਵੀ ਮਿਊਜ਼ੀਅਮ ਘਰ ਵੀ ਬਣਿਆ ਹੋਇਆ ਹੈਗਾ ਹੈ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਦਾ ਹੈਗਾ ਹੈ ਅਤੇ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਸਿੱਖਾਂ ਦੇ ਨੌਵੇਂ ਗੁਰੂ ਹੋਏ ਹੈਗੇ ਜਿਨ੍ਹਾਂ ਦਾ ਸੀਸ ਔਰੰਗਜ਼ੇਬ ਨੇ ਸੋਲ੍ਹਾਂ ਸੋਲ੍ਹਾਂ ਸੌ ਉਨਾਸੀ ਈਸਵੀ ਵਿੱਚ ਉੱਥੇ ਦਿੱਲੀ ਚਾਂਦਨੀ ਚੌਂਕ ਵਿਖੇ ਕਟਵਾ ਦਿੱਤਾ ਸੀਗਾ ਉਹਨਾਂ ਦਾ ਸੰਸ ਸੀਸ ਦਾ ਸੰਸਕਾਰ ਵੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕੀਤਾ ਗਿਆ ਸੀਗਾ ਇਸ ਕਰਕੇ ਮੈਨੂੰ ਆਨੰਦਪੁਰ ਸਾਹਿਬ ਜਾਣਾ ਬੜਾ ਵਧੀਆ ਲੱਗਦਾ ਹੈਗਾ ਅਤੇ ਇੱਥੇ ਮਤਲਬ ਇੱਕ ਅਲੱਗ ਹੀ ਤਰ੍ਹਾਂ ਦਾ ਸਕੂਨ ਮਿਲਦਾ ਹੈਗਾ